ਪਹਿਲਾਂ ਦੇ ਜ਼ਮਾਨੇ ਦੇ ਵਿੱਚ ਖੂਹ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਹਲਟਾਂ ਦਾ ਜਿਹੜਾ ਹੈ ਉਪਯੋਗ ਕੀਤਾ ਜਾਂਦਾ ਸੀਗਾ ਜਾਂ ਜੇ ਘੱਟ ਪਾਣੀ ਦੀ ਲੋੜ ਹੁੰਦੀ ਸੀਗੀ ਕ ਤਾਂ ਬਾਲਟੀ ਜਿਹੜੀ ਕਿ ਇੱਕ ਰੱਸੇ ਦੇ ਨਾਲ ਬੰਨੀ ਹੁੰਦੀ ਸੀ ਉਹਦੇ ਨਾਲ ਪਾਣੀ ਖੂਹ 'ਚੋਂ ਬਾਹਰ ਕੱਢ ਲਿਆ ਜਾਂਦਾ ਸੀ ਪਰ ਅੱਜ ਕੱਲ੍ਹ ਇਹ ਜਿਹੜੀ ਤਕਨੀਕ ਹੈ ਇਹ ਬਦਲ ਚੁੱਕੀ ਹੈ ਜ਼ਿਆਦਾਤਰ ਅੱਜ ਕੱਲ੍ਹ ਜਿਹੜੇ ਆ ਇਲਾਕਿਆਂ ਦੇ ਵਿੱਚ ਸਮਰਸੀਬਲ ਜਿਹੜੀ ਪਾਈਪ ਹੈ ਮੋਟਰ ਹੈ ਉਹਦੇ ਨਾਲ ਪਾਣੀ ਖੂਹ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ